ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਆਮ ਤੌਰ 'ਤੇ ਇੱਕ ਸੁਸਤ ਅਤੇ ਸ਼ਾਂਤ ਵਾਤਾਵਰਨ ਵਿੱਚ ਲਿਖਣਾ ਪਸੰਦ ਕਰਦਾ ਹਾਂ ਮੈਨੂੰ ਸ਼ਾਂਤੀ ਅਤੇ ਸੁਸਤਾਈ ਨੂੰ ਵਾਧਾ ਦੇਣ ਵਾਲੇ ਸਥਾਨਾਂ 'ਤੇ ਬੈਠਣਾ ਪਸੰਦ ਹੈ ਜਿਵੇਂ ਕਿ ਪਾਰਕ ਕੋਫ਼ੀ ਦੁਕਾਨ ਜਾਂ ਕੋਈ ਚਿੱਟੇ ਸਹਿਤ ਕੇਂਦਰ ਮੈਨੂੰ ਆਪਣੇ ਪ੍ਰਬੰਧ ਨੂੰ ਲਿਖਣ ਦੇ ਲਈ ਜ਼ਿਆਦਾ ਸੰਜੀਦਗੀ ਨਾਲ ਪ੍ਰੋਗਰਾਮ ਕਰਨਾ ਪਸੰਦ ਹੈ ਮੈਂ ਆਮ ਤੌਰ 'ਤੇ ਸ਼ੁਰੂ ਕਰਨ ਤੇ ਤਾਜ਼ਗੀ ਰੱਖਦਾ ਹਾਂ ਮੈਨੂੰ ਸਿਰਫ਼ ਪਰਸ਼ਰ ਦੀ ਵਾਤਾਵਰਨ ਵਿੱਚ ਆਪਣੇ ਮਨ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਦਾ ਅਨੁਭਵ ਹੈ ਜੋ ਮੇਰੇ ਲਿਖਤ 'ਚ ਸਪੈਸ਼ਲ ਹੁੰਦਾ ਹੈ ਮੈਂ ਸੋਚ ਵਿਚਾਰ ਕਰਕੇ ਇੱਕ ਸ਼ਾਂਤ ਜਗ੍ਹਾ 'ਤੇ ਜਾ ਕੇ ਆਪਣੇ ਅਨੁਭਵਾਂ ਨੂੰ ਜੋ ਮਹਿਸੂਸ ਕੀਤਾ ਹੁੰਦਾ ਹੈ ਉਹ ਇੱਕ ਲੜੀ ਵਿੱਚ ਪ੍ਰੋਂਦਾ ਹਾਂ ਮੈਨੂੰ ਬਿਲਕੁਲ ਆਰਾਮਦਾਇਕ ਵਾਤਾਵਰਨ ਵਿੱਚ ਲਿਖਣਾ ਬਹੁਤ ਵਧੀਆ ਲੱਗਦਾ ਹੈ ਉੱਥੇ ਜੋ ਸ਼ ਮੇਰੇ ਅੰਦਰ ਇਕ ਜਿਗਿਆਸਾ ਹੁੰਦੀ ਹੈ ਉਹ ਮੇਰੇ ਅੰਦਰੋਂ ਨਿਕਲ ਕੇ ਬਾਹਰ ਆਉਂਦੀ ਹੈ ਅਤੇ ਮੈਂ ਉਹਨੂੰ ਆਪਣੇ ਕਲਮ ਦੇ ਨਾਲ ਲਿਖ ਕੇ ਅਤੇ ਆਪਣੇ ਅਨੁਭਵਾਂ ਨੂੰ ਪੜ੍ਹ ਕੇ ਬੜਾ ਵਧੀਆ ਮਹਿਸੂਸ ਕਰਦਾ ਹਾਂ ਮੈਨੂੰ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਲਿਖਣਾ ਪਸੰਦ ਹੈ

ਦੂਸਰਿਆਂ ਤੋਂ ਅਨੁਭਵ ਪ੍ਰਾਪਤ ਕਰਕੇ ਓ ਸ਼ਾਂਤਮਈ ਢੰਗ ਨਾਲ ਬੈਠ ਕੇ ਉਹਨਾਂ ਨੂੰ ਇੱਕ ਲਿਖਤ ਦੇ ਰੂਪ ਦਿੰਦਾ ਹਾਂ ਧੰਨਵਾਦ ਜੀ